ਹਾਂ ਮੇਰੇ ਕੋਲ ਮੇਰੇ ਬਚਪਨ ਦੀਆਂ ਫੋਟੋਆਂ ਹਾਰਡ ਕਾਪੀ ਵਿੱਚ ਕਲਿਕ ਕੀਤੀਆਂ ਹੋਈਆਂ ਹਨ ਪੁਰਾਣੀਆਂ ਫੋਟੋਆਂ ਅਤੇ ਨਵੀਆਂ ਡਿਜੀਟਲ ਫੋਟੋਆਂ ਦੋਵੇਂ ਵਿਲੱਖਣ ਮਹੱਤਵ ਰੱਖਦੀਆਂ ਹਨ ਨਵੀਆਂ ਡਿਜੀਟਲ ਫੋਟੋਆਂ ਦਾ ਲਾਭ ਇਹ ਆ ਕਿ ਸ ਸਟੋਰ ਇਹਨਾਂ ਨੂੰ ਸੌਖੇ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਜਿਵੇਂ ਆਪਣੇ ਮੋਬਾਇਲ ਫੋਨ ਵਿੱਚ ਪੈਨ ਡਰਾਈਵ ਵਿੱਚ ਜਾਂ ਫਿਰ ਕਲਾਊਡ ਵਿੱਚ ਜਿਵੇਂ ਅੱਜ ਕੱਲ੍ਹ ਗੂਗਲ ਗੂਗਲ ਫੋਟੋਜ ਦਿੰਦਾ ਉਹਦੇ ਵਿੱਚ ਪੰਦਰਾਂ ਜੀ ਬੀ ਡਾਟਾ ਫਰੀ ਮਿਲ ਜਾਂਦਾ ਹੈ ਇਸ ਨਾਲ ਉਸ ਵਿੱਚ ਜਿਹੜੀਆਂ ਆਪਣੀਆਂ ਫੋਟੋਆਂ ਹੈਗੀਆਂ ਉਹ ਸੌਖੇ ਤਰੀਕੇ ਨਾਲ ਸੇਵ ਹੋ ਜਾਂਦੀਆਂ ਹਨ ਅਤੇ ਉਹ ਯਾਨੀ ਕਿ ਜਗ੍ਹਾ ਸਪੇਸ ਘੱਟ ਘੇਰਦੀਆਂ ਪੁਰਾਣੀਆਂ ਫੋਟੋਆਂ ਦੀ ਜਗ੍ਹਾ ਨਵੀਆਂ ਫੋਟੋਆਂ ਨਹੀਂ ਲੈ ਸਕਦੀਆਂ ਕਿਉਂਕਿ ਜਿਹੜੀਆਂ ਪੁਰਾਣੀਆਂ ਫੋਟੋਆਂ ਨੇ ਉਹਨਾਂ ਵਿੱਚ ਆਪਣੀਆਂ ਪੁਰਾਣੀਆਂ ਯਾਦਾਂ ਹੁੰਦੀਆਂ ਨੇ ਪੁਰਾਣੀਆਂ ਯਾਦਾਂ ਦੀ ਭਾਵਨਾ ਨੂੰ ਮਜ਼ਬੂਤ ਕਰਦੀਆਂ ਅੰਗਰੇਜ਼ੀ ਦੀ ਇੱਕ ਕਹਾਵਤ ਹੈ ਕਿ ਓਲਡ ਇਜ ਗੋਲਡ ਇਸ ਨਾਲ ਹੀ ਪੁਰਾਣੀਆਂ ਫੋਟੋਆਂ ਦੀ ਜਗ੍ਹਾ ਨਵੀਆਂ ਫੋਟੋਆਂ ਨਹੀਂ ਲੈ ਸਕਦੀਆਂ ਹੁਣ ਉਸ ਸਮੇਂ ਵਿੱਚ ਜੋ ਤੁਸੀਂ ਸੀ ਜਿਵੇਂ ਹੁਣ ਮੇਰੇ ਕੋਲ ਬਚਪਨ ਦੀਆਂ ਫੋਟੋਆਂ ਪਈਆਂ ਅਤੇ ਹੁਣ ਮੈਂ ਜਦੋਂ ਦੇਖਦੇ ਹਾਂ ਤਾਂ ਉਹ ਇੱਕ ਭਾਵਨਾ ਪੈਦਾ ਹੁੰਦੀ ਕਿ ਬਚਪਨ ਦਾ ਹਜੇ ਵੀ ਆਪਣੇ ਕੋਲ ਉਹ ਸਾਂਭੀਆਂ ਪਈਆਂ ਚੀਜ਼ਾਂ ਇਸ ਨਾਲ ਕੀ ਹੈ ਪੁਰਾਣੀਆਂ ਫੋਟੋਆਂ ਜ਼ਿਆਦਾ ਭਾਵਨਾਤਮਕ ਮੁੱਲ ਹਨ